ਜਿਵੇਂ ਕਿ ਬਾਏ ਪ੍ਰੋਫੈਸ਼ਨ ਮੈਂ ਇੱਕ ਜੋਗ੍ਰਾਫਰ ਹਾਂ ਅਤੇ ਇੱਕ ਕਾਲਜ ਦੇ ਵਿੱਚ ਪੜ੍ਹਾ ਵੀ ਰਹੀ ਹਾਂ ਸੋ ਮੈਨੂੰ ਅਕਸਰ ਹੀ ਟੂਰ 'ਤੇ ਜਾਣਾ ਬੱਚਿਆਂ ਦੇ ਨਾਲ ਜਾਣਾ ਇਕੱਲੇ ਜਾਣਾ ਦੋਨੋਂ ਤਰ੍ਹਾਂ ਨਾਲ ਜਾਣਾ ਹੀ ਪਸੰਦ ਹੈ ਸੋ ਮੈਂ ਮੌਸਟਲੀ ਹਿੱਲੀ ਏਰੀਆ ਜਾਂ ਫਿਰ ਡੈਜ਼ਰਟ ਏਰੀਆ ਦੇ ਵਿੱਚ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਇਨ੍ਹਾਂ ਏਰੀਆ ਦੇ ਵਿੱਚ ਜਾ ਕੇ ਮੈਨੂੰ ਜੋਗਰਫੀ ਨਾਲ ਰਿਲੇਟਡ ਫੀਚਰਸ ਬਾਰੇ ਪਤਾ ਲੱਗਦਾ ਹੈ ਮਾਊਟੇਂਨਸ ਹੋ ਗਏ ਪਲੇਟੂਜ਼ ਹੋ ਗਏ ਪਲੇਨ ਏਰੀਆਸ ਹੋ ਗਏ ਡੈਜ਼ਰਟ ਏਰੀਆਸ ਹੋ ਗਏ ਉਨ੍ਹਾਂ ਦੇ ਵਿੱਚ ਕਿਹੜੇ ਕਿਹੜੇ ਫੀਚਰਸ ਹੈ ਉੱਥੇ ਦਾ ਕਲਾਈਮੇਟ ਕਿਵੇਂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਮੈਨੂੰ ਕੀ ਹੈ ਇਨਫੋਰਮੇਸ਼ਨ ਲੈ ਕੇ ਪ੍ਰੈਕਟੀਕਲੀ ਉਨ੍ਹਾਂ ਚੀਜ਼ਾਂ ਨੂੰ ਦੇਖ ਕੇ ਉਨ੍ਹਾਂ ਨੂੰ ਇਮਲੀਮੈਂਟ ਕਰਕੇ ਬਹੁਤ ਵਧੀਆ ਲੱਗਦਾ ਹੈ ਸੋ ਮੈਂ ਮੋਸਟਲੀ ਵਿੰਟਰਸ ਦੇ ਵਿੱਚ ਟਰੈਵਲ ਕਰਨਾ ਪਸੰਦ ਕਰਦੀ ਹਾਂ ਮਾਉਂ ਡੈਜ਼ਰਟ ਏਰੀਆ ਦੇ ਵਿੱਚ ਔਰ ਸਰਦੀਆਂ ਗਰਮੀਆਂ ਦੇ ਵਿੱਚ ਮੋਸਟਲੀ ਮੈਂ ਕਿਸੇ ਵੀ ਹਿੱਲੀ ਏਰੀਆ ਦੇ ਵਿੱਚ ਟਰੈਵਲ ਕਰਨਾ ਪਸੰਦ ਕਰਦੀ ਹਾਂ